ਹਾਂਜੀ ਪੀ ਟੀ ਊਸ਼ਾ ਬਾਰੇ ਸੁਣਿਆ ਪੀ ਟੀ ਯੂਸ਼ਾ ਇੱਕ ਇੰਡੀਅਨ ਅਥਲੀਟ ਹੈ ਜਿਸਨੇ ਆਪਣੀ ਸ਼ੁਰੂਆਤ ਨਾਈਨਟੀਨ ਸਿਕਸਟੀ ਏਟ ਦੇ ਵਿੱਚ ਕੀਤੀ ਸੀਗੀ ਕੇਰਲਾ ਤੋਂ ਹੈ ਕੇਰਲਾ ਤੋਂ ਵਿੱਚ ਬੋਨ ਐਂਡ ਬਰੋਟਅਪ ਹੋਏ ਆ ਉਸ ਤੋਂ ਬਾਅਦ ਇੰਡੀਅਨ ਵੂਮਨਸ ਦੇ ਵਿੱਚ ਸਭ ਤੋਂ ਬੈਸਟ ਐਥਲੀਟ ਮੰਨੀ ਜਾਂਦੀ ਈਵਨ ਉਹਨੂੰ ਕੁਵੀਨ ਔਫ ਡਰਾਉਨ ਕਿਹਾ ਜਾਂਦਾ ਕਿ ਜਦੋਂ ਰਨ ਕਰਦੇ ਨੇ ਤਾਂ ਉਹਨਾਂ ਦੀ ਸਪੀਡ ਦਾ ਅਜੇ ਤੱਕ ਕਿਸੇ ਨੇ ਕੰ ਕੰਪੇਅਰ ਨਹੀਂ ਕੀਤਾ ਹੈਗਾ ਉਸ ਤੋਂ ਬਾਅਦ ਪੀ ਟੀ ਊਸ਼ਾ ਜੋ ਹੈ ਉਹ ਮਤਲਬ ਉਸਨੇ ਫੋਰ ਗੋਲਡ ਮੈਡਲ ਵੀ ਜਿੱਤੇ ਨੇ ਸੈਵਨ ਸਿਲਵਰ ਮੈਡਲ ਜਿੱਤੇ ਆ ਇੰਡੀਆ ਵਾਸਤੇ ਔਰ ਉਸਨੇ ਰਾਜਿਆ ਸਭਾ ਦਾ ਮੈਂਬਰ ਵੀ ਰਹੀ ਆ ਉਹ ਔਰ ਸ਼ੀ ਇਜ਼ ਦਾ ਫਸਟ ਮਤਲਬ ਉਹ ਫਸਟ ਲੇਡੀ ਸੀ ਜਿਸਨੇ ਨੋਮੀਨੇਟਡ ਹੋ ਕੇ ਨੋਮੀਨੇਟਡ ਐੱਮ ਪੀ ਸੀ ਜਿਹੜੀ ਵਾਈਸ ਚੇਅਰ ਪਰਸਨ ਬਣੀ ਹੈ ਰਾਜਿਆ ਸਭਾ ਦੀ ਤੋ ਬਾਕੀ ਇਹ ਕਿ ਉਹਦੇ ਤੋਂ ਕਾਫ਼ੀ ਕੁਛ ਸਿੱਖਿਆ ਜਾ ਸਕਦਾ ਫਿੱਟਨੈੱਸ ਸਿੱਖੀ ਜਾ ਸਕਦੀ ਹੈ ਆਪਣੇ ਗਰਾਊਂਡ ਰਿਐਲਿਟੀਜ਼ ਦੇ ਨਾਲ ਕਿੱਦਾਂ ਤੁਸੀਂ ਜੁੜ ਕੇ ਰਹਿਣਾ ਹੈ ਉਸ ਤੋਂ ਬਾਅਦ ਆਪਣੇ ਆਪ ਨੂੰ ਐਕਸਪੋਜ਼ਰ ਕਿੱਦਾਂ ਦੇਣਾ ਤੁਸੀਂ ਪੋਲੀਟਿਕਸ 'ਚ ਜਾ ਸਕਦੇ ਹੋ ਲੋਕਾਂ ਦੇ ਲਈ ਭਲਾ ਕਰ ਸਕਦੇ ਹੋ ਉਹਨੇ ਕਾਫ਼ੀ ਚੈਰਟੀ ਪ੍ਰੋਗਰਾਮਸ ਵੀ ਕੀਤੇ ਨੇ